ਆਵਾਜਾਈ ਅਤੇ ਯਾਤਰਾ ਦੇ ਬਹੁਤ ਸਾਰੇ ਵ ਵਿਕਲਪ ਮੌਜੂਦਾ ਸਮੇਂ ਦੇ ਵਿੱਚ ਆਮ ਲੋਕਾਂ ਦੀ ਵਰਤੋਂ ਵਿੱਚ ਆ ਰਹੇ ਹਨ ਜਿਵੇਂ ਕਿ ਸ਼ੁਰੂਆਤ ਦੇ ਵਿੱਚ ਵਿਰਲੇ ਟਾਵੇਂ ਬੰਦਿਆਂ ਕੋਲ ਹੀ ਸਾਈਕਲ ਹੁੰਦੇ ਸਨ ਫਿਰ ਹੌਲੀ ਹੌਲੀ ਸਕੂਟਰ ਮੋਟਰਸਾਈਕਲ ਅਤੇ ਫਿਰ ਕਾਰਾਂ ਦਾ ਪ੍ਰਚਲਨ ਹੋਇਆ ਅਤੇ ਹੁਣ ਤਕਰੀਬਨ ਹਰ ਘਰ ਦੇ ਵਿੱਚ ਇਹ ਤਿੰਨੋਂ ਸਾਧਨ ਮੁਹੱਈਆ ਹਨ ਇਸ ਤੋਂ ਇਲਾਵਾ ਜੋ ਨਵੇਂ ਆਵਾਜਾਈ ਦੇ ਸਾਧਨ ਵਰਤੋਂ ਦੇ ਵਿੱਚ ਆ ਰਹੇ ਹਨ ਉਹਨਾਂ ਦੇ ਵਿੱਚ ਜੋ ਬੈਟਰੀ ਦੇ ਨਾਲ ਚੱਲਣ ਵਾਲੇ ਸਾਧਨ ਹਨ ਭਾਵੇਂ ਉਹ ਮੋਟਰਸਾਈਕਲ ਹੋਵੇ ਕਾਰ ਹੋਵੇ ਸੋ ਇਹਦੇ ਨਾਲ ਜੋ ਇੱਕ ਆਵਾਜਾਈ ਦੇ ਸਾਧਨਾਂ ਵਿੱਚ ਨਵੀਂ ਕ੍ਰਾਂਤੀ ਆਈ ਹੈ ਅਤੇ ਇਸ ਤੋਂ ਇਲਾਵਾ ਜੋ ਪਬਲਿਕ ਜਾਂ ਲੋਕਾਂ ਦੁਆਰਾ ਵਰਤੇ ਜਾਣ ਵਾਲੇ ਸਾਧਨ ਹਨ ਉਹਦੇ ਵਿੱਚ ਰੇਲ ਗੱਡੀਆਂ ਹਵਾਈ ਜਹਾਜ਼ ਇਹ ਆਮ ਬੰਦਿਆਂ ਦੀ ਪਕੜ ਦੇ ਵਿੱਚ ਆਏ ਹਨ ਸੋ ਇਹਨਾਂ ਦੀ ਵਰਤੋਂ ਦੇ ਨਾਲ ਜਿਹੜੀ ਜੀਵਨ ਦੀ ਗੁਣਵੱਤਾ 'ਤੇ ਬਹੁਤ ਡੂੰਘਾ ਪ੍ਰਭਾਵ ਪਿਆ ਹੈ ਅਤੇ ਇਹਦੇ ਨਾਲ ਆਮ ਲੋਕਾਂ ਲਈ ਵਪਾਰ ਕਰਨਾ ਆਉਣਾ ਜਾਣਾ ਸੈਰ ਸਪਾਟੇ ਲਈ ਜਾਣਾ ਉਹ ਬਹੁਤ ਸਹਿਜ ਹੋਇਆ ਹੈ